ਮੀਡੀਆ ਦਾ ਸਾਡੀ ਜ਼ਿੰਦਗੀ 'ਚ ਤਾਂ ਬੜਾ ਰੋਲ ਹੈ ਵੈਸੇ ਮੀਡੀਆ ਆਏ ਗਏ ਕੋਈ ਚੀਜ਼ਾਂ ਬਨਾਵਟੀ ਸਾਨੂੰ ਦਿਖਾ ਦਿੰਦਾ ਬਣਾ ਕੇ ਦਿਖਾਉਂਦਾ ਵੀ ਇੱਥੇ ਆਹ ਹੋ ਗਿਆ ਇੱਥੇ ਆ ਗਿਆ ਅਸਲ ਵਿੱਚ ਉਵੇਂ ਨਹੀਂ ਹੋਇਆ ਹੁੰਦਾ ਮੀਡੀਆ ਹਰੇਕ ਗੱਲ ਨੂੰ ਬਹੁਤ ਹੀ ਚੁੱਕ ਚੱਕ ਕੇ ਦੱਸਦਾ ਕਿ ਉਹਨਾਂ ਦੀ ਟੀ ਆਰ ਸੀ ਵਧੇ ਲੇਕਿਨ ਅ ਸਮਾਜ ਆਪਾਂ ਸਰਸੇ ਵਾਲੇ ਬਾਬੇ ਨੂੰ ਲਾ ਲਈਏ ਮੀਡੀਆ ਕੋਈ ਮੀਡੀਆ ਦੱਸਦਾ ਸੀ ਵੀ ਉਹ ਸਰਸੇ ਵਾਲਾ ਬਾਬਾ ਕੀ ਹੈ ਛੁੱਟ ਗਿਆ ਹੈ ਉਹ ਨਹੀਂ ਗਿਆ ਜੇਲ 'ਚ ਨਹੀਂ ਗਿਆ ਪਰੰਤੂ ਅਸਲ ਵਿੱਚ ਇਵੇਂ ਨਹੀਂ ਸੀ ਉਹ ਜੇਲ 'ਚ ਸੀ ਇਸ ਲਈ ਆਪਾਂ ਹੋਰ ਵੀ ਬੜੀਆਂ ਖ਼ਬਰਾਂ ਨੇ ਜਿਨ੍ਹਾਂ ਬਾਰੇ ਮੀਡੀਆ ਸਾਨੂੰ ਸਹੀ ਜਾਣਕਾਰੀ ਨਹੀਂ ਦਿੰਦਾ ਅਸਲ ਵਿੱਚ ਉਹ ਵਾਪਰ ਨਹੀਂ ਰਹੀ ਹੁੰਦੀਆਂ ਪਰ ਮੀਡੀਆ ਸਾਡੇ ਕੰਨ ਦਿਮਾਗ 'ਚ ਉਲਟ ਪਾ ਦਿੰਦਾ ਹੈ